ਹਾਂਜੀ ਖੁਸ਼ਬੂ ਜੀ ਬੋਲਦੇ ਪਏ ਜੀ ਅ ਜੀ ਮੇਰਾ ਨਾਮ ਹਰਸ਼ਦੀਪ ਹੈ ਜੀ ਹਾਂਜੀ ਮੈਂ ਤੁਹਾਡਾ ਨੰਬਰ ਹੈ ਨਾ ਮੈਨੂੰ ਗੁਰਲੀਨ ਸਿੰਘ ਨੇ ਦਿੱਤਾ ਸੀਗਾ ਅਤੇ ਅਸੀਂ ਜਿੱਦਾਂ ਥੋੜ੍ਹਾ ਹੋਟਲ ਵਗੈਰਾ ਹੋਰ ਰੈਸਟੋਰੈਂਟ ਵਗੈਰਾ ਘੁੰਮਣੇ ਸੀਗੇ ਅਤੇ ਉਹ ਕਹਿੰਦੇ ਸੀਗੇ ਵੀ ਜੇ ਬਾਏ ਚਾਂਸ ਸਾਨੂੰ ਕੋਈ ਪ੍ਰੋਬਲਮ ਆਏ ਤਾਂ ਤੁਸੀਂ ਇਹ ਮਤਲਬ ਮੈਡਮ ਆ ਖੁਸ਼ਬੂ ਜੀ ਇਹਨਾਂ ਨੂੰ ਕੋਲ ਕਰਕੇ ਪੁੱਛ ਲਿਓ ਹਾਂਜੀ ਹਾਂਜੀ ਅਸੀਂ ਕਪੂਰਥਲਾ ਵਿਜਿਟ ਕਰਨਾ ਸੀਗਾ ਇੱਕ ਮਤਲਬ ਆਪਣੀ ਮੇਰੇ ਓ ਫੋ ਬ ਬਰਡੇ ਪਾਰਟੀ ਲਈ ਹਾਂਜੀ ਤੇ ਵਧੀਆ ਕੋਈ ਰੈਸਟੋਰੈਂਟਸ ਵਗੈਰਾ ਚਾਹੀਦਾ ਸੀਗਾ ਕੋਈ ਦੱਸੋ ਮੈਨੂੰ ਹਾਂਜੀ ਓਕੇ ਓਕੇ ਓਕੇ ਅੱਛਾ ਜੀ ਅਤੇ ਮੈਂ ਰਮਾਡਾ ਬਾਰੇ ਤਾਂ ਥੋੜ੍ਹਾ ਸੁਣਿਆ ਥੋੜ੍ਹਾ ਇਹਦੇ ਬਾਰੇ ਦੱਸੋ ਮੈਨੂੰ ਰਮਾਡਾ ਕਿੱਦਾਂ ਦਾ ਹੈਗਾ

ਅੱਛਾ ਅੱਛਾ ਅਤੇ ਸਰਵਿਸ ਵਗੈਰਾ ਕਿੱਦਾਂ ਇਹ ਦੀ ਆ ਵੈਜ਼ੀਟੇਰੀਅਨ ਆ ਨਾ ਮਤਲਬ ਕਿ ਨੋਨ ਵੈਜ਼ੀਟੇਰੀਅਨ ਤਾਂ ਨਹੀਂ ਗਾ ਅੱਛਾ ਵੈਜ਼ੀਟੇਰੀਅਨ ਪਿਓ ਪਿਓਰ ਵੈਜ਼ੀਟੇਰੀਅਨ ਆ ਠੀਕ ਆ ਅਤੇ ਜੇ ਆਪਾਂ ਹੋਮ ਡਿਲੀਵਰੀ ਵਗੈਰਾ ਲੈਣੀ ਹੋਵੇ ਕਰ ਦਿੰਦੇ ਇਹ ਵਾਲੇ ਅੱਛਾ ਜੀ ਅਤੇ ਬਾਕੀ ਉਹ ਫੂਡ ਵਗੈਰਾ ਫਰੈੱਸ਼ ਹੁੰਦਾ ਬਿਲਕੁਲ ਠੀਕ ਆ ਅਤੇ ਮੈਂ ਉੱਦਾਂ ਇਹਦੇ ਬਾਰੇ ਸੁਣਿਆ ਸੀਗਾ ਕਾਫ਼ੀ ਅਤੇ ਬਟ ਮੈਨੂੰ ਪਤਾ ਲੱਗਾ ਸੀਗਾ ਵੀ ਇਹ ਵਧੀਆ ਇਸੇ ਕਰਕੇ ਫਿਰ ਮੈਂ ਕਿਹਾ ਚਲੋ ਇੱਕ ਵਾਰੀ ਪਤਾ ਲੱਗ ਜਾਂਦਾ ਫਿਰ ਬੰਦਾ ਘੁੰਮ ਲੈਂਦਾ ਓਕੇ ਓਕੇ ਮਤਲਬ ਕਰ ਸਕਦੇ ਸਾਰਾ ਆਪਾਂ ਚੈੱਕ ਕਰ ਸਕਦੇ ਹਾਂ ਉਸੀ ਦਿਨ ਮੇਨਲੀ ਬਰਡੇ ਪਾਰਟੀ ਮਨਾਉਣੀ ਆ ਬਸ ਉਹਦੇ ਲਈ ਤੁਹਾਨੂੰ ਪਤਾ ਬਰਡੇ ਪਾਰਟੀ 'ਚ ਕੀ ਕੀ ਚਾਹੀਦਾ ਹੁੰਦਾ ਅੱਛਾ ਫਿਰ ਅ ਅੱਛਾ ਮਤਲਬ ਸਭ ਠੀਕ ਆ ਕਹਿ ਸਕਦੇ ਆਪਾਂ ਕਰ ਸਕਦੇ ਵਿਜਿਟ ਓਕੇ ਮਤਲਬ ਅਸੀਂ ਵਿਜਿਟ ਕਰ ਸਕਦੇ ਹਾਂ ਚਲੋ ਠੀਕ ਆ ਫਿਰ ਕੋਈ ਗੱਲ ਨਹੀਂ ਬਾਕੀ ਇਹਦੇ ਤੇ ਜਦੋਂ ਅਸੀਂ ਆਏ ਕਪੂਰਥਲੇ ਤੁਹਾਨੂੰ ਕੋਂਟੈਕਟ ਕਰਾਂਗੇ ਫਿਰ ਤੁਸੀਂ ਸਾਨੂੰ ਉੱਥੇ ਲੈ ਜਾਇਓ ਠੀਕ ਹੈ ਜੀ ਥੈਂਕਯੂ ਜੀ